ਸਤਿ ਸ਼੍ਰੀ ਅਕਾਲ ਜੀ ਤੁਸੀਂ ਲਾਡੀ ਟੈਕਸੀ ਸਟੈਂਡ ਤੋਂ ਬੋਲ਼ਦੇ ਹੋ ਅਸੀਂ ਅੰਮ੍ਰਿਤਸਰ ਜਾਣਾ ਚਾਹੁੰਦੇ ਹਾਂ ਤਾਂ ਕਰਕੇ ਅਸੀਂ ਤੁਹਾਡੀ ਟੈਕਸੀ ਬੁੱਕ ਕਰਾਉਣਾ ਚਾਹੁੰਦੇ ਹਾਂ ਜਿਸ ਵਿੱਚ ਅਸੀਂ ਹਵੇਲੀ ਵੀ ਰੁਕਣਾ ਹੈ ਅਤੇ ਵਾਹਗਾ ਬੋਰਡਰ ਵੀ ਜਾਣਾ ਹੈ ਅਤੇ ਇੱਕ ਦੋ ਜਗ੍ਹਾ ਹੋਰ ਵੀ ਰੁਕਣਾ ਹੈ ਅਤੇ ਮੇਰੇ ਨਾਲ ਮੇਰੇ ਫੈਮਿਲੀ ਮੈਂਬਰਜ਼ ਵੀ ਹੋਣਗੇ ਅਤੇ ਜੇਕਰ ਸਾਨੂੰ ਕਿਤੇ ਹੋਰ ਰੁਕਣਾ ਪਿਆ ਅਤੇ ਉਹਦਾ ਸਾਰਾ ਖਰਚਾ ਅਤੇ ਟੂਲ ਟੈਕਸ ਦਾ ਖਰਚਾ ਸਾਡਾ ਹੋਵੇਗਾ ਜਾਂ ਤੁਹਾਡਾ ਉਹ ਵੀ ਸਾਨੂੰ ਦੱਸਿਆ ਜਾਵੇ ਅਤੇ ਸਾਰੀ ਜਾਣਕਾਰੀ ਅਤੇ ਕਿੰਨਾ ਖਰਚਾ ਹੋਵੇਗਾ ਇਹ ਦੱਸਿਆ ਜਾਵੇ ਤੁਹਾਡਾ ਧੰਨਵਾਦ